ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਮੈਂ ਖਰੜ ਮੈਂ ਖਰੜ ਤੋਂ ਤੁਹਾਡੀ ਕੈਬ ਕੈਬ ਰਿਸੀਵ ਕਰਨੀ ਸੀ ਪਰ ਰਸਤਾ ਖਰਾਬ ਹੋਣ ਕਾਰਨ ਮੈਂ ਖਰੜ ਤੋਂ ਔਟੋ ਲੈ ਕੇ ਸ਼ਾਮਾ ਢਾਬਾ ਤੱਕ ਆ ਗਈ ਹਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਸ਼ਾਮਾ ਢਾਬਾ ਤੱਕ ਕਦੋਂ ਤੱਕ ਪਹੁੰਚੋਗੇ ਮੈਂ ਇੱਥੇ ਹੀ ਤੁਹਾਡਾ ਵੇਟ ਕਰਦੀ ਹਾਂ